ਮੈਂ ਜੋ ਪਹਿਲਾਂ ਆਨਲਾਈਨ ਪ੍ਰੋਡਕਟ ਹੋਮ ਥੀਏਟਰ ਘਰ ਮੰਗਵਾਇਆ ਸੀ ਉਸਦੀਆਂ ਬਹੁਤ ਸਾਰੀਆਂ ਫੀਚਰਸ ਹਨ ਜਿਸ ਵਿੱਚ ਅਸੀਂ ਮਿਊਜ਼ਿਕ ਜਿਸਨੂੰ ਅਸੀਂ ਐਲ ਈ ਡੀ ਦੇ ਨਾਲ ਅਟੈਚ ਕਰਕੇ ਵੀ ਸੁਣ ਸਕਦੇ ਹਾਂ ਇਸ ਵਿੱਚ ਬੇਸ ਦੀ ਬਹੁਤ ਵਧੀਆ ਕੁਆਲਿਟੀ ਹੈ ਜਿਸ ਨੂੰ ਮੈਂ ਲਗਾਤਾਰ ਦੋ ਸਾਲ ਤੋਂ ਵਰਤੋਂ ਵਿੱਚ ਲਿਆ ਰਿਹਾ ਹਾਂ